ਹੈਲੋ ਸਤਿ ਸ਼੍ਰੀ ਅਕਾਲ ਜੀ ਅੱਛਾ ਅੱਛਾ ਹਾਂ ਰੋਹਿਤ ਹੋਰ ਕਿਵੇਂ ਆ ਰੋਹਿਤ ਵਧੀਆ ਵਧੀਆ ਹੋਰ ਕਿਵੇਂ ਚੱਲ ਰਿਹਾ ਆਸ ਪਾਸ ਸਭ ਸਹੀ ਜੱਚ ਰਿਹਾ ਕਿ ਨਹੀਂ ਅੱਛਾ ਠੀਕ ਹੈ ਹੋਰ ਕਿਸੇ ਤਰ੍ਹਾਂ ਦੀ ਕੋਈ ਪਰੇਸ਼ਾਨੀ ਵਗੈਰਾ ਤਾਂ ਨਹੀਂ ਆ ਰਹੀ ਤੁਹਾਨੂੰ ਹਾਂਜੀ ਦੱਸੋ

ਹਾਂ ਬਿਲਕੁਲ ਬਿਲਕੁਲ ਅੱਛਾ ਠੀਕ ਹੈ ਸਬਜ਼ੀਆਂ ਜੇ ਦੇਖਿਆ ਜਾਵੇ ਜਿਹੜੀਆਂ ਸਭ ਤੋਂ ਤਾਜ਼ਾ ਅਤੇ ਵਧੀਆ ਜੇ ਤੁਹਾਨੂੰ ਸਸਤੇ ਰੇਟ ਅਤੇ ਜਾਈ ਚਾਹੀਦੀਆਂ ਅਤੇ ਉਹ ਫਿਰ ਆਪਾਂ ਨੂੰ ਮੰਡੀ ਦੇ ਵਿੱਚੋਂ ਮਿਲਣਗੀਆਂ ਆਪਣੇ ਸਵੇਰੇ ਜੋ ਹੈਗੀ ਆ ਵੈਸੇ ਤਾਂ ਜਿੱਥੇ ਤੁਸੀਂ ਇਸ ਟਾਈਮ ਰਹਿ ਰਹੇ ਹੋ ਉਥੋਂ ਤੁਹਾਡੇ ਨੇੜੇ ਹੀ ਮਤਲਬ ਕਿ ਥੋੜ੍ਹਾ ਜਿਹਾ ਮੰਨ ਕੇ ਚੱਲੋ ਕਿ ਪੰਜ ਸੌ ਛੇ ਸੌ ਮੀਟਰ ਦੂਰ ਜਾ ਕੇ ਮਤਲਬ ਕਿ ਹੈਗੀ ਆ ਆਪਣੀ ਮੰਡੀ ਹੈਗੀ ਆ ਸਬਜ਼ੀ ਮੰਡੀ ਠੀਕ ਹੈ ਅਤੇ ਸਵੇਰੇ ਮਤਲਬ ਕਿ ਟਾਈਮ ਕੱਢ ਕੇ ਥੋੜ੍ਹਾ ਛੇਤੀ ਉੱਠ ਕੇ ਅਤੇ ਛੇ ਕੁ ਵਜੇ ਆਪਾਂ ਇੱਦਾਂ ਕਰਾਂਗੇ ਆਪਾਂ ਦੋਵੇਂ ਚੱਲ ਵੜਾਂਗੇ

ਹਾਂ ਕੋਈ ਨਹੀਂ ਮੈਂ ਆ ਜਾਊਂਗਾ ਹਾਂ ਕੋਈ ਹਾਂ ਹਾਂ ਕੋਈ ਚੱਕਰ ਨਹੀਂ ਨਾਲੇ ਵਧੀਆ ਨਾਲੇ ਤਾਜ਼ਾ ਸਬਜ਼ੀ ਮਿਲ ਜੂਗੀ ਨਹੀਂ ਜੇ ਸਵੇਰੇ ਜਾਵਾਂਗੇ ਕਿਉਂਕਿ ਜਿਹੜੀ ਮੰਡੀ ਆ ਉਹ ਸਵੇਰੇ ਸਵੇਰੇ ਲਗਦੀ ਹੈ ਸਬਜ਼ੀ ਵਗੈਰਾ ਜਿਹੜੀ ਵੀ ਆਉਂਦੀ ਤਾਜ਼ਾ ਸਬਜ਼ੀ ਆਊਗੀ ਨਾਲੇ ਆਪਾਂ ਨੂੰ ਜੋ ਆ ਕਿ ਘੱਟ ਰੇਟ 'ਤੇ ਮਿਲ ਜਾਏਗੀ ਵਧੀਆ ਜੋ ਵੀ ਤੁਹਾਨੂੰ ਚਾਹੀਦਾ ਹੋਊਗਾ ਸਾਰਾ ਕੁਝ ਉੱਥੇ ਮਿਲ ਜਾਏਗਾ ਇੱਕ ਜਗ੍ਹਾ ਦੇ ਵਿੱਚ ਜੇ ਤੁਸੀਂ ਸਾਗ ਵਗੈਰਾ ਲੈਣੇ ਹੋਏ ਤਾਂ ਉਹ ਵੀ ਤੁਹਾਨੂੰ ਸਾਰਾ ਕੁਝ ਉੱਥੇ ਹੀ ਮਿਲ ਜਾਏਗਾ ਹਾਂ ਹਾਂ ਬਿਲਕੁਲ ਹਾਂ ਹਾਂ ਜਿਵੇਂ ਵੀ ਤੁਹਾਨੂੰ ਸਹੀ ਲੱਗੇ ਜਿੰਨੀ ਵੀ ਕੁਆਂਟਿਟੀ ਦੇ ਵਿੱਚ ਤੁਸੀਂ ਚੀਜ਼ਾਂ ਲੈਣੀਆਂ ਸਾਰਾ ਕੁਝ ਉੱਥੇ ਮਿਲ ਜਾਏਗਾ ਬਾਕੀ ਹੋਰ ਸੇਵਾ ਹਾਂ ਕੋਈ ਨਹੀਂ ਮੈਂ ਆ ਜੂੰਗਾ ਤੁਹਾਨੂੰ ਮੈਂ ਫੋਨ ਕਰ ਦੂੰਗਾ ਠੀਕ ਹੈ ਠੀਕ ਹੈ ਫਿਰ ਓਕੇ ਜੀ ਸਤਿ ਸ਼੍ਰੀ ਅਕਾਲ